ਅਸੀਂ ਹੁਣ ਤੱਕ ਬਹੁਤ ਫੋਟੋਆਂ ਖਿੱਚੀਆਂ ਵਿਆਹ ਸ਼ਾਦੀਆਂ ਅਖੰਡ ਪਾਠ ਵਿੱਚ ਲੰਗਰਾਂ ਵਿੱਚ ਅਤੇ ਹੋਰ ਮੰਦਰਾਂ ਵਿੱਚ ਘੁੰਮਣ ਗਏ ਦੀਆਂ ਫੋਟੋਆਂ ਟੂਰੈਸਟ ਫੋਟੋਆਂ ਹੋਰ ਬੱਸਾਂ ਪਰ ਸਕੂਲਾਂ 'ਚ ਫੋਟੋਆਂ ਕਈ ਤਰ੍ਹਾਂ ਦੀਆਂ ਫੋਟੋਆਂ ਖਿੱਚੀਆਂ ਵਿਆਹ ਸ਼ਾਦੀਆਂ ਵਿੱਚ ਤਾਂ ਗਰੁੱਪ ਫੋਟੋਆਂ ਜ਼ਿਆਦਾ ਖਿੱਚੀਆਂ ਜਾਂਦੀਆਂ ਏ ਅਤੇ ਜਿਵੇਂ ਸ਼ਗਨ ਪਾਉਂਦਿਆਂ ਦੀ ਫੋਟੋਆਂ ਹੋ ਗਈ ਹਾਰ ਪਾਉਂਦਿਆਂ ਦੀ ਫੋਟੋ ਹੋ ਗਈ ਅਤੇ ਹੋਰ ਕਈ ਤਰ੍ਹਾਂ ਦੀਆਂ ਫੋਟੋਆਂ ਹੁੰਦੀਆਂ ਜੋ ਪੋਜ਼ ਵਿੱਚ ਵੀ ਖਿਚਾਈਆਂ ਜਾਂਦੀਆਂ ਏ ਜੋ ਜਿਵੇਂ ਇੱਕ ਦੂਏ ਨੂੰ ਸ਼ਗਨ ਮਿਲਾ ਸ਼ਗਨ ਪਾਉਂਦਿਆ ਦੀਆਂ ਹੱਥ ਮਿਲਾਉਂਦਿਆਂ ਦੀਆਂ ਜੱਫੀ ਪਾਉਂਦਿਆਂ ਦੀਆਂ ਹੋਰ ਵੀ ਬਹੁਤ ਤਰ੍ਹਾਂ ਦੀਆਂ ਫੋਟੋਆਂ ਹੁੰਦੀਆਂ ਏ ਜਿਵੇਂ ਲੰਗਰ ਵਿੱਚ ਬੈਠਿਆਂ ਦੀ ਗਰੁੱਪ ਫੋਟੋ ਖਿੱਚ ਤੀ ਸ਼ਗਨ ਪਾਉਂਦਿਆਂ ਦੀ ਗਰੁੱਪ ਫੋਟੋ ਖਿੱਚ ਲਈ ਅਤੇ ਹੋਰ ਜਿਵੇਂ ਮਰਗਤਾਂ ਦੇ ਵੀ ਫੋਟੋ ਖਿੱਚੀ ਜਾਂਦੀ ਹੈ ਬੰਦਾ ਮਰ ਗਿਆ ਉਸ ਦੀ ਭੋਗ ਦੀ ਫੋਟੋ ਖਿੱਚ ਦਿੱਤੀ ਜਾਂਦੀ ਹੈ ਹੋਰ ਵੀ ਬਹੁਤ ਤਰ੍ਹਾਂ ਦੀਆਂ ਫੋਟੋਆਂ ਹੁੰਦੀਆਂ ਏ ਜਿਵੇਂ ਅਸੀਂ ਘੁੰਮਣ ਗਏ ਮੋਲ ਵਿੱਚ ਖਿੱਚੀਆਂ ਫੋਟੋਆਂ ਹੋਰ ਕਈ ਜਗ੍ਹਾ ਤੁਸੀਂ ਸਮਝ ਸਕਦੇ ਜਿਵੇਂ ਕਈ ਤਰ੍ਹਾਂ ਦੀਆਂ ਫੋਟੋਆਂ ਹੁੰਦੀਆਂ ਬਹੁਤ ਤਰ੍ਹਾਂ ਦੀਆਂ ਫੋਟੋਆਂ ਹੁੰਦੀਆਂ ਗਰੁੱਪ ਫੋਟੋਆਂ ਹੋਗੀਆਂ ਭੰਗੜਾ ਵਾਲ਼ੀਆਂ ਫੋਟੋਆਂ ਹੋਗੀਆਂ ਭੰਗੜਾ ਪਾਉਂਦੇ ਦੀਆਂ ਦਾਰੂ ਪੀਦੇਂ ਦੀਆਂ ਡਰਿੰਕ ਕਰਦੇ ਦੀਆਂ ਹੋਰ ਅੱਲਮ ਕੱਲਮ ਬਹੁਤ ਫੋਟੋਆਂ ਖਿੱਚੀਆਂ ਅਸੀਂ ਫੋਟੋਆਂ ਦਾ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ ਪੋਜ਼ ਫੋਟੋਆਂ ਹੁੰਦੀਆਂ ਏ ਗਰੁੱਪ ਫੋਟੋਆਂ ਹੁੰਦੀਆਂ ਭੰਗੜੇ ਵਾਲ਼ੀਆਂ ਫੋਟੋਆਂ ਹੁੰਦੀਆਂ ਹੋਰ ਅੱਛਾ ਵਿਆਹ ਸ਼ਾਦੀਆਂ ਵਾਲ਼ੀਆਂ ਹੁੰਨੀਆ ਏ ਗਰੁੱਪ ਫੋਟੋ ਹੋ ਗਈ ਫੋਟੋਆਂ ਦਾ ਕੋਈ ਅੰਤ ਨਹੀਂ ਗਾ ਫੋਟੋਆਂ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਏ